ਆਪਣੇ ਸਰੀਰ ਨੂੰ ਫਿਟ ਰੱਖਣ ਦੇ ਲਈ ਤੰਦਰੁਸਤ ਰੱਖਣ ਦੇ ਲਈ ਅਸੀਂ ਅਨੇਕਾਂ ਪ੍ਰਕਾਰ ਦੀਆਂ ਜੋ ਕਿਰਿਆਵਾਂ ਨੇ ਉਹ ਕਰਦੇ ਆ ਇਹਨਾਂ ਵਿੱਚੋਂ ਜੋ ਅਸੀਂ ਕਸਰਤ ਜਾਂ ਕਿਰਿਆਵਾਂ ਕਰਦੇ ਹਾਂ ਉਹਨਾਂ ਵਿੱਚੋਂ ਇੱਕ ਕਾਫੀ ਮਹੱਤਵਪੂਰਨ ਤੇ ਪੁਰਾਣੀ ਕਿਰਿਆ ਹੈ ਦੌੜਨਾ ਸੋ ਦੌੜਦੇ ਸਮੇਂ ਸਾਨੂੰ ਕਈ ਵਾਰ ਸੱਟ ਵੀ ਲੱਗ ਜਾਂਦੀ ਹੈ ਅਤੇ ਉਸਦਾ ਮੌਕੇ ਦੇ ਉੱਤੇ ਜੋ ਹੈ ਸਾਨੂੰ ਇਲਾਜ ਕਰਨਾ ਪੈਂਦਾ ਹੈ ਸੋ ਮੈਨੂੰ ਵੀ ਅਨੇਕਾਂ ਵਾਰ ਜਦੋਂ ਅਸੀਂ ਸਟੇਡੀਅਮ ਦੇ ਵਿੱਚ ਦੌੜਨ ਜਾਂਦੇ ਹਾਂ ਰਨਿੰਗ ਕਰਦੇ ਆਂ ਕਈ ਵਾਰ ਸਾਨੂੰ ਅਨੇਕਾਂ ਮੌਕੇ ਹੁੰਦੇ ਨੇ ਜਦੋਂ ਸਾਨੂੰ ਕਈ ਵਾਰੀ ਕੋਈ ਸੱਟ ਵਗੈਰਾ ਆਦੀ ਲੱਗ ਜਾਂਦੀ ਹੈ ਤਾਂ ਕਈ ਵਾਰ ਮੈਨੂੰ ਇਨਾ ਸੱਟਾਂ ਦਾ ਅਨੁਭਵ ਹੋਇਆ ਹੈ ਤਾਂ ਮੌਕੇ ਤੇ ਮੇਰੇ ਨਾਲ ਤੇ ਜੋ ਸਾਥੀ ਨੇ ਉਹਨਾਂ ਨੇ ਇਸ ਸੱਟ ਨੂੰ ਵਧਣ ਤੋਂ ਰੋਕਣ ਦੇ ਲਈ ਮੈਨੂੰ ਮੁਢਲੀ ਸਹਾਇਤਾ ਜੋ ਹੈ ਪ੍ਰਦਾਨ ਕੀਤੀ ਹੈ ਨਾਲ ਦੀ ਨਾਲ ਉਹਦੇ ਉਸ ਜਗਾ ਨੂੰ ਸਾਫ ਕੀਤਾ ਗਿਆ ਪੱਟੀ ਲਗਾਈ ਗਈ ਅਤੇ ਜੇ ਕੋਈ ਥੋੜਾ ਬਹੁਤ ਖੂਨ ਵੀ ਬਾਹਰ ਆਉਂਦਾ ਸੀ ਤਾਂ ਉਸਨੂੰ ਵੀ ਸੰਭਾਲਿਆ ਗਿਆ ਰੋਕਿਆ ਗਿਆ ਅਤੇ ਕੁਝ ਸਮੇਂ ਬਾਅਦ ਹੀ ਮੈਨੂੰ ਪਹਿਲਾਂ ਵਾਲੀ ਸਥਿਤੀ ਦੇ ਵਿੱਚ ਲਿਆਂਦਾ ਜਾਂਦਾ ਹੈ ਧੰਨਵਾਦ